ਰੂਪਨਗਰ ਜ਼ਿਲ੍ਹੇ ਦੇ ਵਿੱਚ ਕੁਝ ਆਮ ਅਤੇ ਸੱਭਿਆਚਾਰਿਕ ਜਾਂ ਸਮਾਜਿਕ ਅਭਿਆਸ ਅਤੇ ਰੀਤੀ ਰਿਵਾਜ਼ਾਂ ਹਨ ਇੱਥੇ ਬਹੁਤ ਸਾਰੀਆਂ ਰੀਤੀ ਰਿਵਾਜ਼ਾਂ ਅਪਣਾਈਆਂ ਜਾਂਦੀਆਂ ਹਨ ਜਿਵੇਂ ਕਿ ਆਪਸੀ ਭਾਈਚਾਰਾ ਅਤੇ ਹੋਰ ਸਾਰੇ ਪ੍ਰੋਗਰਾਮ ਕੀਤੇ ਜਾਂਦੇ ਹਨ ਜਿਵੇਂ ਕਿ ਕ੍ਰਿਸਮਿਸ ਦੇ ਤਿਉਹਾਰ ਅਤੇ ਹੋਰ ਤਿਉਹਾਰ ਮਨਾਏ ਜਾਂਦੇ ਹਨ ਜਿਹਨਾਂ ਵਿੱਚੋਂ ਮੇਨ ਕਰਕੇ ਸਿੱਖ ਧਰਮ ਦੇ ਵਿੱਚ ਸ਼ਹੀਦੀ ਜੋੜ ਮੇਲਾ ਜੋ ਕਿ ਇੱਥੇ ਭੱਠਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਲੱਗਦਾ ਹੈ ਜਿਹਦੇ ਵਿੱਚ ਬਹੁਤ ਸਾਰੀ ਸੰਗਤ ਹੁੰਮਹੁੰਮਾ ਕੇ ਪਹੁੰਚਦੀ ਹੈ ਅਤੇ ਬਹੁਤ ਸਾਰੇ ਸੰਗਤ ਦ ਦਰਸ਼ਨ ਕਰਨ ਆਉਂਦੀ ਹੈ ਜਿਹਨਾਂ ਵਿੱਚੋਂ ਸਾਰੇ ਧਰਮ ਦੇ ਲੋਕ ਜਿਹੜੇ ਇੱਥੇ ਦਰਸ਼ਨ ਕਰਨ ਆਉਂਦੇ ਹਨ ਅਤੇ ਆਪਣੀ ਖੁਸ਼ੀ ਪ੍ਰਾਪਤ ਕਰਨ ਆਉਂਦੇ ਹਨ ਅਤੇ ਆਪਸੀ ਭਾਈਚਾਰਾ ਅਤੇ ਇਹ ਜ਼ਿਲ੍ਹੇ ਦੀ ਪਛਾਣ ਵੀ ਹੈ ਕਿਉਂਕਿ ਇੱਥੋਂ ਜਿਹੜਾ ਰੋਪੜ ਸ਼ ਜ਼ਿਲ੍ਹੇ ਦੇ ਵਿੱਚ ਜਿਹੜੀ ਹੈਗੀ ਹੈ ਸਭਾ ਵੀ ਸ਼ੁਰੂ ਹੁ ਕੀਤੀ ਜਾਂਦੀ ਹੈ ਸੋ ਇੱਥੋਂ ਸ਼ੁਰੂ ਹੁੰਦੀ ਹੈ ਅਤੇ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਮੇਨ ਇਤਿਹਾਸ ਅਤੇ ਸ਼ਹੀਦੀ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ ਅਤੇ ਸ ਇਹ ਇਹਦਾ ਸਮਾਜਿਕ ਅਤੇ ਸੱਭਿਆਚਾਰਿਕ ਰੀਤੀ ਰਿਵਾਜ਼ ਦੇ ਉੱਤੇ ਕਾਫੀ ਜ਼ਿਆਦਾ ਫਰਕ ਵੀ ਦੇਖਣ ਨੂੰ ਮਿਲਦਾ ਹੈ ਆਪਸ ਦੇ ਵਿੱਚ ਲੋਕ ਭਾਈਚਾਰਾ ਕ ਕਰਕੇ ਲੰਗਰ ਦੀ ਸੇਵਾ ਵੀ ਨਿਭਾਉਂਦੇ ਹਨ ਅਤੇ ਆਪਸੀ ਸਾਨੂੰ ਭਾਈਚਾਰਾ ਸ ਜਗ੍ਹਾ ਜਗ੍ਹਾ ਦੇਖਣ ਨੂੰ ਮਿਲਦਾ ਹੈ ਜਿਹਦਾ ਸਾਡੇ ਜ਼ਿਲ੍ਹੇ ਦੀ ਪਛਾਣ ਅਤੇ ਜ਼ਿਲ੍ਹੇ ਦੀ ਹੋਂਦ ਦੇ ਵਿੱਚ ਬਹੁਤ ਸਾਰਾ ਇੱਕ ਸਕਾਰਾਤਮਕ ਪ੍ਰਭਾਵ ਵੀ ਦੇਖਣ ਨੂੰ ਮਿਲਦਾ ਹੈ